ਤੰਦਰੁਸਤੀ ਸਾਨੂੰ ਵੱਧ ਤੋਂ ਵੱਧ ਖੇਡਣਾ ਚਾਹੀਦਾ ਜਿਵੇਂ ਗਰਾਊਂਡ 'ਚ ਅੱਜ ਕੱਲ੍ਹ ਪਿੰਡਾਂ ਵਿੱਚ ਕਬੱਡੀ ਹੋਗੀ ਫੁੱਟਬਾਲ ਹੋ ਗਿਆ ਵਾਲੀਬਾਲ ਹੋ ਗਈ ਇਹ ਬਹੁਤ ਵੱਧ ਤੋਂ ਵੱਧ ਮੁੰਡੇ ਖੇਲਦੇ ਸ਼ਹਿਰਾਂ ਵਿੱਚ ਕੀ ਹੈ ਸ਼ਹਿਰਾਂ ਵਿੱਚ ਮੁੰਡੇ ਬਸ ਫੋਨ ਚੱਕ ਲੈਂਦੇ ਆ ਫੋਨ ਨਾਲ ਕੀ ਹੁੰਦਾ ਮਤਲਬ ਬਿਮਾਰ ਹੁੰਦਾ ਡਿਪਰੈਸ਼ਨ ਦੀ ਬਿਮਾਰੀ ਨਿਗ੍ਹਾ ਅੱਖਾਂ ਉੱਪਰ ਜ਼ੋਰ ਪੈਣਾ ਡਿਪਰੈਸ਼ਨ ਹੋਣਾ ਇ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਆਪਣਾ ਖੇਡਣਾ ਚਾਹੀਦਾ ਵੀ ਬੰਦਾ ਆਪਣਾ ਖੇਡੋ ਦੌੜ ਲਾਓ ਰਨਿੰਗ ਕਰੋ ਸਵੇਰ ਸ਼ਾਮ ਉੱਠੋ ਦੌੜ ਲਾਓ ਸਾਜਰੇ ਹੀ